ਇੱਕ ਜੀਰੋ ਜੀਰੋ ਸੱਤ ਦੋ ਅੱਠ ਨੌਂ ਨੌਂ ਨੌਂ ਨੌਂ ਨੌਂ ਦੋ ਪੰਜ ਚਾਰ ਪੰਜ ਛੇ ਚਾਰ ਅੱਠ ਪੰਜ ਚਾਰ ਇੱਕ